ਮੇਰਾ ਨਾਮ ਮੋਨਿਕਾ ਹੈ ਮੈਂ ਰ ਪਿੰਡ ਰੈਲ ਮਾਜਰੇ ਵਿੱਚ ਰਹਿੰਦੀ ਹਾਂ ਅੱਜ ਮੈਂ ਆਪਣੀ ਸਹੇਲੀ ਦੇ ਨਾਲ ਉਸਦੇ ਘਰ ਗਈ ਅਤੇ ਮੈਂ ਉਸ ਨੂੰ ਦੇਖਿਆ ਕੀ ਉਹ ਅੱਜ ਕੱਲ੍ਹ ਸਬਜ਼ੀ ਦੀਆਂ ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਜਿਵੇਂ ਕਿ ਰਸਗੁੱਲੇ ਗੁਲਾਬ ਜਾਮਣ ਅਤੇ ਹੋਰ ਵੀ ਕਈ ਪ੍ਰਕਾਰ ਦੀ ਰੈਸਪੀ ਬਣਾ ਕੇ ਯੂਟਿਊਬ ਉੱਤੇ ਪਾਉਂਦੀ ਹੈ ਅਤੇ ਮੈਂ ਟੀ ਵੀ 'ਚ ਵੀ ਬਹੁਤ ਵਾਰ ਦੇਖਿਆ ਉੱਥੇ ਵੀ ਕਈ ਪ੍ਰਕਾਰ ਦੇ ਜਿਵੇਂ ਸਬਜ਼ੀ ਵਗੈਰਾ ਅਤੇ ਹੋਰ ਵੀ ਅਲੱਗ ਅਲੱਗ ਤਰ੍ਹਾਂ ਦੇ ਚੀਜ਼ਾਂ ਪਾਉਂਦੇ ਹਨ ਮੈਂ ਉਸਨੂੰ ਕਿਹਾ ਮੈਨੂੰ ਵੀ ਇਹ ਕੰਮ ਤੂੰ ਸਿਖਾ ਦੇ ਉਹਨੇ ਮੈਨੂੰ ਬੋਲਿਆ ਤੂੰ ਮੇਰੇ ਰੈਸਪੀ ਦੇਖਿਆ ਕਰ ਅਤੇ ਉਸ ਤੂੰ ਵੀ ਉਸਨੂੰ ਇਸਤੇਮਾਲ ਕਰਕੇ ਦੇਖ ਤੈਨੂੰ ਵੀ ਬਹੁਤ ਪਸੰਦ ਆਵੇਗੀ ਤਾਂ ਮੈਂ ਉਸਦੀ ਇਹ ਗੱਲ ਮੰਨ ਕੇ ਉਸਦੀ ਵੀਡੀਓ ਨੂੰ ਲਾਈਕ ਕਰਦੀ ਹੈ ਅਤੇ ਉਸ ਤੇ ਚੈਨਲ ਨੂੰ ਲਾਈਕ ਕਰਕੇ ਹੋਰਾਂ ਨੂੰ ਵੀ ਪ੍ਰੇਰਿਤ ਕਰਦੀ ਹੈ ਕਿ ਤੁਸੀਂ ਵੀ ਇਹ ਰੇਸੀਪੀ ਦੇਖੋ ਅਤੇ ਬਣਾ ਕੇ ਦੇਖੋ ਜੇ ਤੁਹਾਨੂੰ ਵੀ ਪਸੰਦ ਆਵੇ ਤੁਸੀਂ ਵੀ ਇਹ ਚੀਜ਼ਾਂ ਬਣਾ ਬਣਾ ਕੇ ਆਪਣੇ ਘਰਦਿਆਂ ਨੂੰ ਖਿਲਾਓ ਅਤੇ ਉਹਨਾਂ ਨੇ ਵੀ ਬਹੁਤ ਸਾਰਿਆਂ ਨੂੰ ਇਹ ਰੈਸਪੀ ਬਣਾ ਕੇ ਖਿਲਾਈ